ਪਰੰਪਰਾਗਤ ਮੌਕਿਆਂ 'ਤੇ ਨੱਚਦੇ ਸਮੇਂ ਲੋਕ ਬਹੁਤ ਸਾਰਾ ਆਪਣੇ ਆਪਣੇ ਪ੍ਰਾਚੀਨ ਪਹਿਰਾਵੇ ਪਹਿਨਦੇ ਹਨ ਪੰਜਾਬ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦਾ ਪ੍ਰਾਚੀਨ ਨ੍ਰਿਤਿਆ ਭੰਗੜਾ ਹੈ ਭੰਗੜਾ ਇੱਕ ਅਜਿਹਾ ਨਾਚ ਹੈ ਜੋ ਪੰਜਾਬੀ ਆਪਣੇ ਖੁਸ਼ੀ ਦੇ ਮੌਕਿਆਂ 'ਤੇ ਕਰਦੇ ਹਨ ਇਸ ਵਿੱਚ ਇਹਨਾਂ ਦਾ ਪਹਿਰਾਵਾ ਇਹ ਹੈ ਕਿ ਜੋ ਮੁੰਡਾ ਹੈ ਉਹ ਕੁੜਤਾ ਪਜਾਮਾ ਜਾਂ ਕੁੜਤਾ ਲੂੰਗੀ ਨਾਲ ਪੱਗ ਬੰਨਦਾ ਹੈ ਅਤੇ ਕੁੜੀਆਂ ਸੂਟ ਪਾਉਂਦੀਆਂ ਹਨ ਪੰਜਾਬੀ ਸੂਟ ਜਿਹਨਾਂ ਦਾ ਥੱਲੇ ਪੋਹਚਿਆ 'ਤੇ ਕਈਆਂ ਦੇ ਤੰਗ ਅਤੇ ਕਈਆਂ ਦੇ ਖੁੱਲ੍ਹੇ ਹੁੰਦੇ ਹਨ ਜਿੰਦੂ ਨੂੰ ਤੂਹਾਨੂੰ ਤੁਸੀਂ ਪਲਾਜੋ ਵੀ ਕਹਿ ਸਕਦੇ ਹੋ ਅਤੇ ਗੁੱਤ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਿਰ ਉੱਤੇ ਕਰਕੇ ਲਿਪਸਟਿਕ ਲਪੂਸਿਟ ਲਾ ਕੇ ਅੱਖਾਂ ਵਿੱਚ ਕੱਜਲ ਲਾ ਕੇ ਸ ਕਰਦੇ ਹਨ ਮੁੰਡੇ ਪੱਗ ਵਿੱਚ ਬਹੁਤ ਹੀ ਕੋਸ਼ਿਸ਼ ਕਰਦੇ ਹਨ ਅਤੇ ਇੱਕ ਡੰਡਾ ਕੈਂਚੀ ਲੈ ਕੇ ਨੱਚਦੇ ਹਨ ਅਲੱਗ ਅਲੱਗ ਸਟੇਜਾਂ 'ਤੇ ਆ ਕੇ ਅਲੱਗ ਅਲੱਗ ਚੁੱਕਦੇ ਹਨ ਜਿਵੇਂ ਪਹਿਲੇ ਖਾਲੀ ਹੱਥ ਨਾਲ ਭੰਗੜਾ ਕਰਦੇ ਹਨ ਫਿਰ ਕੈਂਚੀ ਲੈਂਦੇ ਹਨ ਫਿਰ ਡੰਡਾ ਲੈਂਦੇ ਹਨ ਅਤੇ ਕਈ ਲੋਕ ਤਾਂ ਸੰਗੀਤ ਵਾਲੀ ਤਾਰਾਂ ਵੀ ਲੈ ਕੇ ਨੱਚਦੇ ਹਨ ਅਤੇ ਪੈਰਾਂ ਵਿੱਚ ਤਿੱਲੇਦਾਰੀ ਜੁੱਤੀ ਪਾਉਂਦੇ ਹਨ ਪਰ ਇੱਕ ਚੀਜ਼ ਬਹੁਤ ਜ਼ਰੂਰੀ ਹੈ ਜੋ ਹੈ ਕਿ ਮੁੰਡੇ ਦੀ ਪੱਗ ਦਾ ਰੰਗ ਕੁੜੀ ਦੀ ਚੁੰਨੀ ਨਾਲ ਮੈਚ ਹੋਣਾ ਚਾਹੀਦਾ ਹੈ